ਦੌੜਨਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਜਿਵੇਂ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਹਰ ਇੱਕ ਵਿਅਕਤੀ ਮੋਟਾ ਹੋਈ ਜਾਂਦਾ ਅਤੇ ਉਸ ਨੂੰ ਆਪਣੇ ਸਰੀਰ ਦਾ ਕੋਈ ਵੀ ਸੁੱਧ ਬੁੱਧ ਨਹੀਂ ਰਹਿੰਦੀ ਉਹ ਪਿਆ ਹੀ ਰਹਿੰਦਾ ਅਤੇ ਟੈਂਸ਼ਨ ਦੇ ਵਿੱਚ ਹੋਰ ਜਾਈ ਜਾਂਦਾ ਇਸ ਲਈ ਜੇ ਅਸੀਂ ਦੌੜਾਂਗੇ ਤਾਂ ਉਹ ਸਾਡੇ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੋਊਗਾ ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਦੌੜਨ ਨਾਲ ਸਾਡੀਆਂ ਮਾਸਪੇਸ਼ੀਆਂ ਵੀ ਵੱਧਦੀਆਂ ਹਨ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਅਤੇ ਸਾਨੂੰ ਹਾਰਟ ਅਟੈਕ ਦੇ ਚਾਂਸਿਸ ਵੀ ਘੱਟ ਹੀ ਰਹਿੰਦੇ ਆ ਅਤੇ ਸਾਨੂੰ ਕਿਸ ਮੌਸਮ ਦਾ ਅਤੇ ਕਦੋਂ ਕਿੱਦਾਂ ਦੌੜਨਾ ਚਾਹੀਦਾ ਇਸ ਬਾਰੇ ਵੀ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਜੇ ਸਾਨੂੰ ਨਹੀਂ ਪਤਾ ਹੋਊਗਾ ਤਾਂ ਅਸੀਂ ਬਿਮਾਰ ਹੋ ਸਕਦੇ ਹਾਂ ਜਾਂ ਸਾਡੇ ਸੱਟਾਂ ਵੱਜ ਸਕਦੀਆਂ ਅਤੇ ਜਿਸ ਨਾਲ ਸਾਡੀਆਂ ਸਿਹਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਅਸੀਂ ਵੇਖ ਸਕਦੇ ਹਾਂ ਕਿ ਤਿੰਨ ਤਰ੍ਹਾਂ ਦੇ ਹੀ ਮੌਸਮ ਹੁੰਦੇ ਗਰਮੀ ਠੰਡ ਅਤੇ ਬਰਸਾਤ ਗਰਮੀ ਦੇ ਮੌਸਮ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਸਾਨੂੰ ਦੌੜਨਾ ਚਾਹੀਦਾ ਹੈ ਇਸ ਵਿੱਚ ਇਸ ਚੀਜ਼ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਕਿ ਅਸੀਂ ਪਾਣੀ ਸਮੇਂ 'ਤੇ ਸਮੇਂ ਪੀਂਦੇ ਰਹੀਏ ਤਾਂ ਕਿ ਸਾਨੂੰ ਬੇਹੋਸ਼ੀ ਨਾ ਹੋ ਜਾਵੇ ਅਸੀਂ ਕਿਤੇ ਡਿੱਗ ਨਾ ਜਾਈਏ ਅਤੇ ਧਿਆਨ ਰੱਖਣਾ ਹੈ ਕਿ ਸਵੇਰੇ ਤੋਂ ਲੈ ਕੇ ਦੁਪਹਿਰ ਤੀਕਰ ਨਹੀਂ ਦੌੜਨਾ ਸਿਰਫ ਇੱਕ ਲਿਮਿਟ ਤੱਕ ਹੀ ਦੌੜਨਾ ਹੈ ਅਤੇ ਬਰਸਾਤ ਦੇ ਮੌਸਮ ਦੇ ਵਿੱਚ ਸਾਡੇ ਕੋਲ ਸਹੀ ਕਿਸਮ ਦੇ ਬੂਟ ਹੋਣੇ ਚਾਹੀਦੇ ਹਨ ਜਿਹਨਾਂ ਦੇ ਨਾਲ ਸਾਨੂੰ ਤਿਲਕਣ ਨਾ ਹੋਵੇ ਅਸੀਂ ਕਿਤੇ ਡਿੱਗ ਕੇ ਨਾ ਜਾਈਏ ਸਾਡੇ ਕਿਤੇ ਸੱਟ ਨਾ ਵੱਜ ਜਾਵੇ ਇਸ ਚੀਜ਼ ਦਾ ਅਸੀਂ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਣਾ ਹੈ ਠੰਡ ਦੇ ਮੌਸਮਾਂ ਦੇ ਵਿੱਚ ਸਾਨੂੰ ਸ਼ਾਮ ਨੂੰ ਜਾਂ ਫਿਰ ਇੱਦਾਂ ਦੇ ਸਮੇਂ 'ਤੇ ਦੌੜਨਾ ਚਾਹੀਦਾ ਜੋ ਕਿ ਸਾਨੂੰ ਸਹੀ ਲੱਗੇ ਸਾਡੇ ਸਰੀਰ ਲਈ ਉਹ ਚੀਜ਼ ਸਹੀ ਹੋਵੇ ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਜੇ ਅਸੀਂ ਸਰਦੀਆਂ 'ਚ ਜ ਜ਼ਿਆਦਾ ਦੌੜਾਂਗੇ ਤਾਂ ਸਾਡੇ ਸਰੀਰ ਵਿੱਚ ਗਰਮੀ ਹੋਊਗੀ ਉਹ ਗਰਮੀ ਨਾਲ ਸਾਨੂੰ ਹੋਰ ਵਧੀਆ ਮਹਿਸੂਸ ਹੋਊਗਾ ਤਾਂ ਕਰਕੇ ਸਾਨੂੰ ਵੀ ਧਿਆ ਇਹਨਾਂ ਸਭ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ